ਓ ਯਾਰ ਕੱਲ੍ਹ ਨਾ ਮੈਂ ਕੱਪੜੇ ਲੈ ਕੇ ਆਇਆ ਸੀ ਅਰਬਨ ਸਟੇਟ ਤੋਂ ਹਾਂ ਫੇਸ ਵੰਨ ਤੋਂ ਜਿਹੜੀ ਮੇਨ ਬਿਲਡਿੰਗ ਆ ਸੈਕਿੰਡ ਫਲੋਰ ਤੋਂ ਹਾਂ ਜਿਹੜਾ ਨਾਈਕੀ ਦਾ ਸ਼ੋਅ ਰੂਮ ਆ ਯਾਰ ਕੱਪੜੇ ਬੜੇ ਵਧੀਆ ਸੀ ਉਹਨਾਂ ਦੇ ਹਾਂ ਹਾਂ ਏਟੀ ਪ੍ਰਸੈਂਟ ਔਫ ਸੀ ਉਹ ਨਹੀਂ ਨਹੀਂ ਮੈਂ ਕੱਲ੍ਹ ਲੈ ਕੇ ਆਇਆ ਉਥੋਂ ਹਾਂ ਮੈਂ ਲੈ ਕੇ ਆਇਆ ਤਿੰਨ ਚਾਰ ਲੋਅਰਾਂ ਲੈ ਕੇ ਆਇਆ ਸੀ ਦੋ ਤਿੰਨ ਟਰੈਕ ਸੂਟ ਲੈ ਕੇ ਆਇਆ ਅਤੇ ਤਿੰਨ ਸ਼ੂਜ਼ ਦੇ ਜੋੜੇ ਲੈ ਕੇ ਆਇਆ ਉਹ ਹਾਂ ਕੁਆਲਿਟੀ ਬੜੀ ਵਧੀਆ ਉਹਨਾਂ ਦੀ ਮੀ ਅਫੋਰਡੇਬਲ ਪ੍ਰਾਈਜ਼ ਆ ਉਹਨਾਂ ਦਾ ਉਹਦੀ ਬਹੁਤ ਵਧੀਆ ਨੇ ਹਾਂ ਤੂੰ ਵੀ ਚੱਲੀ ਕੱਲ੍ਹ ਮੇਰੇ ਨਾਲ ਕੋਈ ਨਾ ਤੂੰ ਮੈਨੂੰ ਫੋਨ ਕਰੀਂ ਕੱਲ੍ਹ ਸ਼ਾਮ ਨੂੰ ਪੰਜ ਕੁ ਵਜੇ ਕਰੀਂ ਫੋਨ ਮੈਂ ਪੰਜ ਕੁ ਵਜੇ ਫਰੀ ਹੋਊਗਾ ਫਿਰ ਆਪਾਂ ਚੱਲਾਂਗੇ ਨਾ ਬਹੁਤ ਵਧੀਆ ਨੇ ਉਹਨਾਂ ਦੇ ਉਹਨਾਂ ਦੀ ਕੁਆਲਿਟੀ ਬਹੁਤ ਵਧੀਆ ਕੱਪੜਾ ਐਨ ਵਧੀਆ ਐਨ ਵੀ ਕੋਈ ਐਂ ਨੀ ਵੀ ਵੀ ਮਾੜਾ ਕੱਪੜਾ ਵੀ ਕੁਆਲਿਟੀ ਵੀ ਐਨ ਘੈਂਟ ਹੈ ਐਨ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਵੀ ਪ੍ਰਾਈਜ ਵੀ ਬੜਾ ਵੀ ਵਧੀਆ ਵੀ ਆਪਣੇ ਆਪਣੇ ਵੱਸ ਦਾ ਹੈਗਾ ਪ੍ਰਾਈਜ ਵੀ ਹਾਂ ਚੱਲ ਕੋਈ ਨਾ ਫਿਰ ਕੱਲ੍ਹ ਫੋਨ ਕਰੀਂ ਤੂੰ ਮੈਨੂੰ ਫਿਰ ਚੱਲਾਂਗੇ ਆਪਾਂ ਦੋਨੋਂ ਠੀਕ ਹੈ ਓਕੇ ਬਾਏ